ਹਾਂਜੀ ਮੇਰਾ ਪਹਿਲਾ ਪੋਜਟਿਵ ਐਕਸਪੀਰੀਅੰਸ ਰਿਹਾ ਮੈਂ ਮੋਬਾਈਲ ਇੱਕ ਔਨਲਾਈਨ ਪਰਚੇਜ਼ ਕੀਤਾ ਸੀਗਾ ਉਹ ਮੈਨੂੰ ਉਹਦਾ ਬਹੁਤ ਬੈਨੀਫਿਟ ਹੋਇਆ ਮੈਂ ਐੱਸ ਬੀ ਆਈ ਉਹਨਾਂ ਨੇ ਮੈਨੂੰ ਓਪਸ਼ਨ ਦਿੱਤੀ ਸੀਗੀ ਕਿ ਐੱਫ ਸੀ ਐੱਸ ਬੀ ਆਈ ਕਾਰਡ ਤੋਂ ਤੁਸੀਂ ਅਗਰ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ ਕੈਸ਼ ਬੈਕ ਮਿਲੇਗਾ ਅਤੇ ਨਾਲੇ ਤੁਹਾਨੂੰ ਔਫਰਸ ਕਾਫੀ ਮਿਲਣਗੀਆਂ ਅਤੇ ਮੈਂ ਫਿਰ ਉਹਦੇ ਤੋਂ ਰੈਡਮੀ ਨੋਟ ਏਟ ਫੋਨ ਜਿਹੜਾ ਆ ਉਹ ਮੈਂ ਉਹ ਤੋਂ ਪਰਚੇਸ ਕੀਤਾ ਜਿਹਦੀ ਕੋਸਟ ਉਸ ਟਾਈਮ 'ਤੇ ਫਿਫਟੀਨ ਥਾਊਂਜੈਂਟ ਦੇ ਅਬਾਊਟ ਸੀਗੀ ਬਟ ਮੈਨੂੰ ਉਹਦੇ ਤੋਂ ਔਫਰ ਮਿਲਣ ਦੇ ਕਰਕੇ ਮੈਨੂੰ ਉਹਨਾਂ ਨੇ ਕਾਫੀ ਔਫ 'ਚ ਦਿੱਤਾ ਮੈਨੂੰ ਦਸ ਹਜ਼ਾਰ ਦੇ ਅਰਾਊਂਡ ਮਿਲਿਆ ਬਟ ਉਹਦੀ ਕੁਆਲਿਟੀ ਉਹਦੇ ਫੀਚਰਸ ਉਹਦੇ ਕੰਪੋਨੈਂਟਸ ਬਹੁਤ ਹੀ ਅੱਛੇ ਮੈਨੂੰ ਮੇਰੇ ਰਿਵਿਊ 'ਚ ਬਹੁਤ ਵਧੀਆ ਰਿਹਾ ਉਹ ਫੋਨ ਔਨਲਾਈਨ ਪਰਚੇਜ਼ ਕਰਨ ਤੋਂ ਪਹਿਲਾਂ ਮੈਂ ਬਹੁਤ ਘਬਰਾਉਂਦੀ ਸੀ ਬਟ ਜਦੋਂ ਐਕਸਪੀਰੀਅੰਸ ਕੀਤਾ ਉਸ ਤੋਂ ਬਾਅਦ ਆਈ ਐਮ ਵੈਰੀ ਹੈਪੀ ਕਿ ਔਨਲਾਈਨ ਸਰਵਿਸ ਵੀ ਕਾਫੀ ਵਧੀਆ ਆ ਮੇਰੇ ਫੋਨ ਦੀ ਕੁਆਲਿਟੀ ਬਹੁਤ ਅੱਛੀ ਹੈ ਉਹਦੀ ਵਨ ਟਵੈਨਟੀ ਏਟ ਜੀ ਬੀ ਰੈਮ ਹੈ ਐਕਸਟਰਨਲ ਅਤੇ ਅ ਇੰਟਰਨਲ ਸਿਕਸਟੀ ਫੋਰ ਹੈ ਪੰਜ ਹਜ਼ਾਰ ਮੈਗਾ ਪਿਕਸਲ ਉਹਦੀ ਬੈਟਰੀ ਬੈਕਅਪ ਹੈ ਅਤੇ ਸਕਰੀਨ ਜਿਹੜੀ ਆ ਉਹਦੀ ਉਹ ਵੀ ਸਿਕਸ ਪੁਆਇੰਟ ਫਾਈਵ ਹੈ ਓਕਟਾ ਕੋਰ ਪ੍ਰੋਸੈਸਰ ਹੈ ਮੇਰਾ ਸਾਰਾ ਕਮਰਸ਼ੀਅਲ ਕੰਮ ਸਾਰਾ ਫੋਨ 'ਤੇ ਹੀ ਹੈ ਅਤੇ ਮੈਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਈ ਬਿਲਕੁਲ ਬਹੁਤ ਵਧੀਆ ਤਰੀਕੇ ਮੇਰਾ ਫੋਨ ਚੱਲ ਰਿਹਾ ਕਾਫੀ ਵਾਰੀ ਮੈਂ ਬੜਾ ਰਫਲੀ ਯੂਜ਼ ਵੀ ਕੀਤਾ ਕਈ ਕਈ ਵਾਰੀ ਨੀਚੇ ਵੀ ਗਿਰਿਆ ਕਈ ਵਾਰੀ ਕੁਛ ਹੋਇਆ ਨੀਚੇ ਡਿੱਗਿਆ ਕਦੀ ਕੋਈ ਪ੍ਰੋਬਲਮ ਨਹੀਂ ਆਈ ਨਾ ਹੈਂਗਿੰਗ ਪ੍ਰੋਬਲਮ ਆਈ ਨਾ ਸਕਰੀਨ ਦੀ ਕੋਈ ਦਿੱਕਤ ਆਈ ਕਾਫੀ ਅੱਛਾ ਮੈਨੂੰ ਪ੍ਰੋਡਕਟ ਔਨਲਾਈਨ ਪਰਚੇਜ਼ ਤੋਂ ਬਾਅਦ ਮਿਲ ਗਿਆ ਅਤੇ ਮੈਂ ਤਾਂ ਬਾਏ ਕਰਨਾ ਮਸਟ ਚਾਹੂੰਗੀ ਪ੍ਰੋਡਕਟ ਬਹੁਤ ਅੱਛਾ ਨਿਕਲਿਆ ਮੇਰਾ ਥੈਂਕ ਯੂ